ਮੇਰਾ ਨਾਮ ਰਾਕੇਸ਼ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਜੇ ਮੈਂ ਗੱਲ ਕਰਾਂ ਤਾਂ ਸਾਡੇ ਨੇੜੇ ਕਿਹੜੇ ਕਿਹੜੇ ਕੋਲਜ ਹਨ ਅਤੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਕੋਰਸ ਹਨ ਸਰਕਾਰ ਵੱਲੋਂ ਇੱਥੇ ਕੁਝ ਸਰਕਾਰੀ ਕੋਲਜ ਅਤੇ ਇੰਸਟਿਚਿਊਟ ਵੀ ਖੋਲ੍ਹੇ ਗਏ ਹਨ ਜਿਹਦੇ ਵਿੱਚ ਸਾਡੇ ਨੇੜੇ ਇੱਕ ਕੋਲਜ ਹੈ ਜੋ ਕਿ ਗੁਰੂ ਨਾਨਕ ਦੇਵ ਕੋਲਜ ਹੈ ਕਿ ਉਹ ਇੱਕ ਸਰਕਾਰੀ ਕੋਲਜ ਹੈ ਇੱਥੇ ਵੱਖ ਵੱਖ ਕੋਰਸ ਉਪਲੱਬਧ ਹਨ ਪਰ ਕੁਝ ਕੋਰਸਾਂ ਦੀ ਘਾਟ ਹੋਣ ਕਰਕੇ ਇੱਥੋਂ ਦੇ ਬੱਚਿਆਂ ਨੂੰ ਸਾਡੇ ਨੇੜੇ ਵਾਲੇ ਪ੍ਰਾਈਵੇਟ ਕੋਲਜਾਂ ਵਿੱਚ ਐਡਮਿਸ਼ਨ ਲੈਣੀ ਪੈਂਦੀ ਹੈ ਅਤੇ ਕੁਝ ਕੋਲਜਾਂ ਦੇ ਨਾਂ ਹਨ ਜਿਵੇਂ ਐਸਡੀ ਕੋਲੇਜ ਅਤੇ ਆ ਅਮਨ ਭੱਲਾ ਕੋਲਜ ਜ਼ਿਆਦਾਤਰ ਹਾਇਰ ਕੋਰਸ ਅਵੈਲੇਬਲ ਹਨ ਪਰ ਕੁਝ ਬੱਚਿਆਂ ਲਈ ਇੱਥੋਂ ਦੇ ਕੈਂਪਸ ਜਾਂ ਫੈਸਿਲਿਟੀ ਸਟਾਫ ਚੰਗਾ ਨਹੀਂ ਲੱਗਦਾ ਇਸ ਲਈ ਉਹਨਾਂ ਬੱਚਿਆਂ ਨੂੰ ਹੋਰ ਦੂਰ ਨੇੜੇ ਵਾਲੇ ਕੋਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਜਾਣਾ ਪੈਂਦਾ ਹੈ ਜਿਵੇਂ ਕਿ ਸਾਡੇ ਖੇਤਰ ਦੇ ਵਿੱਚ ਇੱਕ ਗੁਰਦਾਸਪੁਰ ਵਿਖੇ ਬੇਅੰਤ ਕੋਲਜ ਓਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਹੈ ਜੋ ਹੁਣ ਸਰਦਾਰ ਬੇਅੰਤ ਸਿੰਘ ਸਟੇਜ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਹੈ ਉੱਥੇ ਪੜ੍ਹਨ ਜਾਂਦੇ ਹਨ ਬੱਚੇ ਕਿਉਂਕਿ ਇੱਕ ਤਾਂ ਉਹ ਸਰਕਾਰੀ ਯੂਨੀਵਰਸਿਟੀ ਹੈ ਅਤੇ ਉੱਥੋਂ ਦਾ ਆਂ ਫਕੀਲਟੀ ਸਟਾਫ ਵੀ ਕਾਫੀ ਮਿਹਨਤੀ ਅਤੇ ਹਾਈ ਕੁਆਲੀਫਾਈਡ ਪ੍ਰਫਾਈਲ ਵਾਲਾ ਹੈ ਅਤੇ ਇੱਥੇ ਹਰ ਤਰ੍ਹਾਂ ਦੇ ਕੋਰਸ ਹੁੰਦੇ ਹਨ ਜਿਵੇਂ ਕਿ ਬੀਟੈਕ ਜਾਂ ਹੋਰ ਕਈ ਕੋਰਸ ਅਵੇਲੇਬਲ ਹਨ ਅਤੇ ਵੱਖ ਵੱਖ ਬ੍ਰਾਂਚਾ ਵੀ ਹਨ ਜਿਵੇਂ ਮਕੈਨੀਕਲ ਦਾ ਵੀ ਵੱਖਰੀ ਬ੍ਰਾਂਚ ਹੈ ਅਤੇ ਆਪਣੇ ਹਿਸਾਬ ਨਾਲ ਬੱਚੇ ਆਪਣੀ ਰੁਚੀ ਦੇ ਅਨੁਸਾਰ ਆਪਣੇ ਕੋਰਸ ਲੈਂਦੇ ਹਨ ਅਤੇ ਆਪਣੀ ਪੜ੍ਹਾਈ ਨੂੰ ਪੂਰਾ ਕਰਦੇ ਹਨ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਇਹੋ ਜਿਹੀ ਨੇੜਲੇ ਕੋਲਜਾਂ ਦਾ ਅਤੇ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਆਪਣੀ ਸਰਕਾਰ ਦਾ ਧੰਨਵਾਦ